ਜਾਅਲੀ ਖਬਰਾਂ ਅੱਜ ਦੇ ਟਰੈਂਡ ਵਿੱਚ ਜਾਅਲੀ ਖਬਰਾਂ ਦਾ ਬਹੁਤ ਜ਼ਿਆਦਾ ਟਰੈਂਡ ਚੱਲ ਰਿਹਾ ਅੱਜ ਦੇ ਸਮੇਂ ਵਿੱਚ ਜੋ ਸ਼ੋਸ਼ਲ ਮੀਡੀਆ ਇਹ ਸਭ ਤੋਂ ਜ਼ਿਆਦਾ ਜਾਅਲੀ ਖਬਰਾਂ ਦੂਜਿਆਂ ਨੂੰ ਪਰਜੈਂਟ ਕਰਦੇ ਹੈ ਕੁਛ ਖਬਰਾਂ ਅਧੂਰੀਆਂ ਦਿਖਾ ਕੇ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੈ ਭਰੋਸੇਯੋਗ ਸੂਤਰ ਭਰੋਸੇਯੋਗ ਸਰੋਤ ਅਤੇ ਜਾਅਲੀ ਖਬਰਾਂ ਦੇ ਵਿਚਕਾਰ ਉਸਨੂੰ ਦੇਖਿਆ ਜਾਵੇ ਕਿ ਇਹ ਖਬਰ ਕਿਸ ਦੇ ਨਾਲ ਰਿਲੇਟ ਹੈ ਅਤੇ ਵੱਖ ਵੱਖ ਖਬਰਾਂ ਦੇ ਚੈਨਲਾਂ ਤੋਂ ਜਾਂ ਖਬਰਾਂ ਦੇ ਸਰੋਤਾਂ ਤੋਂ ਉਸਨੂੰ ਪਹਿਲਾਂ ਵੈਰੀਫਾਈ ਕੀਤਾ ਜਾਵੇ ਪਹਿਲਾਂ ਉਨ੍ਹਾਂ ਨੂੰ ਨਿਰਧਾਰਿਤ ਕੀਤਾ ਜਾਵੇ ਵੀ ਸਹੀ ਹੈ ਫੇਰ ਉਸ ਤੋਂ ਬਾਅਦ ਉਸ ਖਬਰ 'ਤੇ ਵਿਸ਼ਵਾਸ ਕੀਤਾ ਜਾਵੇ ਅੱਜ ਕੱਲ੍ਹ ਦੇ ਯੁੱਗ ਵਿੱਚ ਤਾਂ ਇਹ ਬਹੁਤ ਜ਼ਿਆਦਾ ਪ੍ਰਚੱਲਿਤ ਹੋ ਗਿਆ ਕਿ ਖਬਰਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ